ਤੈਰਾਕਾਂ ਦੇ ਕੰਨ ਅਤੇ ਹੋਰ ਸੱਟਾਂ ਨੂੰ ਰੋਕਣ ਲਈ ਬਹੁਤ ਜ਼ਿਆਦਾ ਤਰੀਕੇ ਹਨ ਜਿਨ੍ਹਾਂ ਦੇ ਵਿੱਚ ਮੇਨ ਸਾਡਾ ਪਾਣੀ ਗੰਦਲਾ ਨਾ ਹੋਵੇ ਅਤੇ ਤੈਰਾਕੀ ਕਰਨ ਵਾਲੇ ਨੂੰ ਪਾਣੀ ਦੇ ਵਿੱਚ ਚਸ਼ਮਾ ਲਗਾ ਕੇ ਜਾਣਾ ਚਾਹੀਦਾ ਅਤੇ ਉਸਨੂੰ ਚਸ਼ਮੇ ਦੇ ਵਿੱਚੋਂ ਦਿਖਣਾ ਚਾਹੀਦਾ ਕੰਨਾਂ ਦੇ ਵਿੱਚ ਉਸ ਨੂੰ ਰੋਕਣ ਦੇ ਲਈ ਇੱਕ ਕਿੱਟ ਦੇ ਵਿੱਚ ਹੁੰਦਾ ਉਹ ਉਹ ਚੀਜ਼ ਕੰਨਾਂ ਦੇ ਵਿੱਚ ਪਾ ਕੇ ਫੇਰ ਹੀ ਤੈਰਾਕੀ ਕਰਨੀ ਚਾਹੀਦੀ ਹੈ ਅਤੇ ਪੂਰੀ ਡਰੈੱਸ ਹੋਣੀ ਚਾਹੀਦੀ ਹੈ ਅਤੇ ਥੱਲੇ ਕੱਚੀ ਥਾਂ ਪਾਣੀ ਦੇ ਵਿੱਚ ਨਹੀਂ ਜਾਣਾ ਚਾਹੀਦਾ ਜਿੱਥੇ ਕਿ ਕੋਈ ਚੀਜ਼ ਪਾਣੀ ਦੇ ਵਿੱਚ ਘਾਤ ਲਗਾਈ ਬੈਠੀ ਹੋਵੇ ਤਾਂ ਉਸ ਤੋਂ ਬਚਣਾ ਚਾਹੀਦਾ ਕੱਚੀ ਜਗ੍ਹਾ ਦੇ ਵਿੱਚ ਪੈਰ ਨਹੀਂ ਰੱਖਣਾ ਚਾਹੀਦਾ ਅਤੇ ਪੂਰੀ ਪਰੋਪਰ ਕਿੱਟ ਦੇ ਨਾਲ ਹੀ ਪਾਣੀ ਦੇ ਵਿੱਚ ਉਤਰਨਾ ਚਾਹੀਦਾ ਅਤੇ ਪੂਰੀ ਬਬਲਿੰਗ ਕਰਨੀ ਚਾਹੀਦੀ ਹੈ ਅਤੇ ਹੱਥ ਪੈਰ ਵੀ ਪੂਰੇ ਦਿਸ਼ਾ ਡਰੈਕਸ਼ਨ ਦੇ ਵਿੱਚ ਸਹੀ ਮਾਰਨੇ ਚਾਹੀਦੇ ਹਨ ਜਿਸ ਦੇ ਨਾਲ ਤ ਤੈਰਾਕ ਵਧੀਆ ਢੰਗ ਦੇ ਨਾਲ ਤਾਰੀ ਲਾ ਸਕੇ ਅਤੇ ਉਸਨੂੰ ਨਾਲ ਗਾਈਡੈਂਸ ਦੇ ਲਈ ਇੱਕ ਪੋਸ਼ਾਕ ਚਸ਼ਮਾ ਵੀ ਕੈਰੀ ਕਰਨਾ ਚਾਹੀਦਾ ਅਤੇ ਵਧੀਆ ਬਰੈਂਡਿੰਡ ਨਿੱਕਰ ਵੀ ਪਾਉਣੀ ਚਾਹੀਦੀ ਹੈ ਪੂਰੀ ਡਰੈੱਸ ਦੇ ਨਾਲ ਹੀ ਪਾਣੀ ਦੇ ਵਿੱਚ ਉਤਰਨਾ ਚਾਹੀਦਾ